ਮੈਂ ਸਿਲਾਈ ਦਾ ਕੰਮ ਕਰਨਾ ਕਿਸੇ ਤੋਂ ਸਿੱਖਿਆ ਹੈ ਪਹਿਲੇ ਤਾਂ ਕੱਪੜੇ ਨੂੰ ਚੰਗੀ ਤਰ੍ਹਾਂ ਪ੍ਰੈਸ ਕੀਤਾ ਜਾਂਦਾ ਹੈ ਫਿਰ ਉਸਨੂੰ ਪੁੱਠਾ ਕਰਕੇ ਚੰਗੀ ਤਰ੍ਹਾਂ ਸਿੱਧਾ ਕਰ ਦਿੱਤਾ ਜਾਂਦਾ ਹੈ ਤਾਂ ਜੋ ਕੱਪੜੇ ਦੀ ਕਟਿੰਗ ਸਹੀ ਤਰੀਕੇ ਹੋਵੇ ਅਤੇ ਬਰਾਬਰ ਹੋਵੇ ਅਤੇ ਤਾਂ ਪੁੱਠਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਪੁੱਠੇ 'ਤੇ ਸਿਲਾਈ ਆਵੇ ਉਸਨੂੰ ਡਬਲ ਕੀਤਾ ਜਾਂਦਾ ਹੈ ਤਾਂ ਜੋ ਅੱਗੇ ਅਤੇ ਪਿੱਛੇ ਵਾਲੀ ਸਿਲਾਈ ਸਹੀ ਆਵੇ ਫਿਰ ਉਸਨੂੰ ਉਸ ਵਿੱਚੋਂ ਕਮੀਜ਼ ਅਤੇ ਸਲਵਾਰ ਦੀ ਕਟਿੰਗ ਕੀਤੀ ਜਾਂਦੀ ਹੈ ਇੱਕ ਜਾਂ ਔਰਤ ਲਈ ਜਾਂ ਜਨਾਨੀ ਲਈ ਪੰਜ ਮੀਟਰ ਕੱਪੜੇ ਵਿੱਚੋਂ ਸੂਟ ਨਿਕਲ ਜਾਂਦਾ ਹੈ ਪਹਿਲੇ ਤਾਂ ਕਮੀਜ਼ ਦੀ ਕਟਿੰਗ ਕੀਤੀ ਜਾਂਦੀ ਹੈ ਕਮੀਜ਼ ਦੀ ਕਟਿੰਗ ਲਈ ਪਹਿਲੇ ਕੱਪੜੇ ਨੂੰ ਚੰਗੀ ਤਰ੍ਹਾਂ ਪੁੱਠਾ ਕਰਕੇ ਉਸਨੂੰ ਚਹੁਰਾ ਕੀਤਾ ਜਾਂਦਾ ਹੈ ਜਾਂ ਚਾਰ ਕਰ ਲਓ ਜਾਂ ਦੋ ਕਰ ਲਓ ਦੋ ਕਰਕੇ ਜਾਂ ਚਾਰ ਕਰਕੇ ਉਸਨੂੰ ਕਟਿੰਗ ਕੀਤੀ ਜਾਂਦੀ ਹੈ ਪਹਿਲੇ ਉਸਦਾ ਤੀਰਾ ਅਤੇ ਉਸਦਾ ਮੋਢਾ ਰੱਖਿਆ ਜਾਂਦਾ ਹੈ ਫਿਰ ਉਸਦੀ ਗਲਾ ਰੱਖਿਆ ਜਾਂਦਾ ਹੈ ਜਾਂ ਫਿਰ ਉਸਦੀ ਫਿਟਿੰਗ ਰੱਖੀ ਜਾਂਦੀ ਹੈ ਛਾਤੀ ਕਮਰ ਅਤੇ ਉਸਦੀ ਹਿੱਪ ਰੱਖੀ ਜਾਂਦੀ ਹੈ ਇਸ ਤਰ੍ਹਾਂ ਕਮੀਜ਼ ਦੀ ਕਟਿੰਗ ਹੋ ਜਾਂਦੀ ਹੈ ਅਤੇ ਸਲਵਾਰ ਦੀ ਕਟਿੰਗ ਲਈ ਵੀ ਸਾਨੂੰ ਸੱਤ ਇੰਚ ਉੱਪਰ ਬੈਲਟ ਅਤੇ ਫਿਰ ਵੱਟ ਕੱਢਣੇ ਪੈਂਦੇ ਹਨ ਅਤੇ ਫਿਰ ਖੁੰਦੇ ਅਤੇ ਪੂਰਾ ਪੌਂਚਾ ਰੱਖਣਾ ਪੈਂਦਾ ਹੈ ਇਸ ਤਰ੍ਹਾਂ ਸਾਡੀ ਸਿਲਾਈ ਹੁੰਦੀ ਹੈ